ਮੇਰੇ ਅਨੁਸਾਰ ਭੰਗੜਾ ਐਰੋਬਿਕਸ ਹੋਰ ਕਸਰਤ ਵਿਕਲਪਾਂ ਦੇ ਮੁਕਾਬਲੇ ਜ਼ਿਆਦਾ ਬਹੁਤ ਜ਼ਿਆਦਾ ਦਿਲਚਸਪ ਹੈ ਕਿਉਂਕਿ ਇਹਦੇ ਵਿੱਚ ਮਨੋਰੰਜਨ ਵੀ ਹੋ ਜਾਂਦਾ ਹੈ ਇਹਦੇ ਨਾਲ ਨਾਲ ਮੰਨੋਰੰਜਨ ਹੁੰਦਾ ਹੈ ਕਸਰਤ ਵੀ ਕਸਰਤ ਦੀ ਕਸਰਤ ਅਤੇ ਮਨੋਰੰਜਨ ਦਾ ਮਨੋਰੰਜਨ ਕਿਉਂਕਿ ਇਹਦੇ ਇਹ ਕਰਨ ਵਾਸਤੇ ਜਦੋਂ ਅਸੀਂ ਆਰੋਬਿਕਸ ਕਰਦੇ ਹਾਂ ਤਾਂ ਨਾਲ ਗੀਤ ਵੀ ਚਲਾਏ ਜਾਂਦੇ ਹਨ ਗੀਤ ਸੰਗੀਤ ਇਨਸਾਨ ਦਾ ਇੱਕ ਬਹੁਤ ਹੀ ਜ਼ਿਆਦਾ ਮਨਪਸੰਦ ਕਿੱਤਾ ਹੈ ਇਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਬਹੁਤ ਹੀ ਰੁਚੀ ਲੈਂਦੇ ਹਨ ਇਸ ਲਈ ਜਦੋਂ ਭੰਗੜਾ ਐਰੋਬਿਕਸ ਕਰਵਾਏ ਜਾਂਦੇ ਹਨ ਬੱਚੇ ਬੱਚੇ ਬਹੁਤ ਹੀ ਜ਼ਿਆਦਾ ਖੁਸ਼ ਅਤੇ ਵਧੀਆ ਮਹਿਸੂਸ ਕਰਦੇ ਹਨ ਇਹ ਇਕ ਮਨਪਸੰਦ ਗੇਮ ਦੀ ਤਰ੍ਹਾਂ ਹੋ ਗਿਆ ਹੈ ਜਿਹਦੇ ਵਿੱਚ ਔਰਤਾਂ ਮਰਦ ਅਤੇ ਬਜ਼ੁਰਗ ਔਰਤਾਂ ਬਜ਼ੁਰਗ ਮ ਮਰਦ ਸਭ ਹੀ ਬੜੀ ਹੀ ਖੁਸ਼ੀ ਨਾਲ ਭਾਗ ਲੈਂਦੇ ਹਨ ਅਤੇ ਇਹ ਆਪਣੀ ਸਿਹਤ ਬਣਾਉਂਦੇ ਹਨ ਇਹ ਸਿਹਤ ਬਣਾਉਣ ਦਾ ਇੱਕ ਬਹੁਤ ਹੀ ਵਧੀਆ ਤਰੀਕਾ ਹੈ ਜੋ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰਚਲਨ ਵਿੱਚ ਹੈ ਇਸ ਨੂੰ ਸਾਰੇ ਹੀ ਬਹੁਤ ਹੀ ਵਧੀਆ ਅਤੇ ਆਸਾਨੀ ਨਾਲ ਸਿੱਖ ਲੈਂਦੇ ਹਨ ਅਤੇ ਬਹੁਤ ਸੇ ਸਾਰੇ ਬੱਚਿਆਂ ਲਈ ਇਹ ਇੱਕ ਸਿਹਤ ਬਣਾਉਣ ਦਾ ਬਹੁਤ ਹੀ ਅੱਛਾ ਅਤੇ ਬਹੁਤ ਵਧੀਆ ਤਰੀਕਾ ਹੈ ਧੰਨਵਾਦ